ਹਾਂਜੀ ਤੁਸੀਂ ਅਮਨ ਢਾਬੇ ਤੋਂ ਬੋਲਦੇ ਹੋ ਮੈਂ ਕੁਝ ਚੀਜ਼ਾਂ ਔਡਰ ਕਰਵਾਈਆਂ ਸੀ ਅਤੇ ਪਨੀਰ ਅਤੇ ਚਪਾਤੀ ਰੋਟੀ ਅਤੇ ਮੇਰੇ ਕੋਲ ਸਬਜ਼ੀ ਨਹੀਂ ਪਹੁੰਚੀ ਅਤੇ ਮੈਂ ਸ਼ਿਕਾਇਤ ਦਰਜ ਕਰਾਉਣਾ ਚਾਹੁੰਦੀ ਹਾਂ ਅਤੇ ਜਿਹੜਾ ਤੁਹਾਡਾ ਡਿਲੀਵਰੀ ਬੋਆਏ ਸੀਗਾ ਅਤੇ ਉਹ ਮੇਰੇ ਕੋਲ ਸਿਰਫ ਚਪਾਤੀ ਰੋਟੀ ਲੈ ਕੇ ਆਇਆ ਅਤੇ ਸਬਜ਼ੀ ਨਹੀਂ ਲੈ ਕੇ ਆਇਆ ਅਤੇ ਕਿਰਪਾ ਕਰਕੇ ਮੇਰੀ ਜਿਹੜੀ ਸ਼ਿਕਾਇਤ ਹੈ ਉਹਨੂੰ ਦਰਜ ਕੀਤੀ ਜਾਵੇ